ਜਦੋਂ ਵੀ ਮੈਂ ਲਿਖਦਾ ਹਾਂ ਇੱਕ ਇੱਕ ਉਸਦੇ ਸੰਬੰਧੀ ਚਿੰਤਾ ਵੀ ਹੁੰਦੀ ਹੈ ਸ਼ੱਕ ਵੀ ਹੁੰਦਾ ਹੈ ਵੀ ਜੋ ਮੈਂ ਲਿਖਦਾ ਹਾਂ ਕੀ ਇਹ ਦੂਜਿਆਂ ਨੂੰ ਲੋਕਾਂ ਨੂੰ ਪਸੰਦ ਆਗ ਆਵੇਗਾ ਵੀ ਕਿ ਜਾਂ ਨਹੀਂ ਆਵੇਗਾ ਇਸ ਲਈ ਨਜਿੱਠਣ ਵਾਸਤੇ ਮੈਂ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਰੱਖ ਕੇ ਨਜਿੱਠਦਾ ਕੋਸ਼ਿਸ਼ ਕਰਦਾ ਹਾਂ ਵੀ ਜੋ ਵੀ ਮੈਂ ਲਿਖਾਂ ਉਹ ਲੋਕਾਂ ਲਈ ਲਿਖਾਂ ਤਾਂ ਜੋ ਲੋਕਾਂ ਨੂੰ ਪਸੰਦ ਆਵੇ ਲੋਕਾਂ ਨੂੰ ਪ੍ਰਭਾਵਿਤ ਕਰੇ ਕਿਉਂਕਿ ਲੋਕ ਜੋ ਤੁਸੀਂ ਲਿਖਦੇ ਹੋ ਲੋਕਾਂ ਨੇ ਹੀ ਉਸਦਾ ਸਮਰਥਨ ਕਰਨਾ ਹੈ ਜੇ ਜਿਹੜੀ ਵੀ ਲਿਖਤ ਲੋਕਾਂ ਨੂੰ ਪਸੰਦ ਆਉਂਦੀ ਹੈ ਉਹੀ ਪ੍ਰਵਾਨ ਚੜ੍ਹਦੀ ਹੈ ਇਸ ਕਰਕੇ ਮੈਂ ਜਦੋਂ ਵੀ ਲਿਖਦਾ ਹਾਂ ਸਿਰਫ ਆਪਣੇ ਨਿੱਜੀ ਅਨੁਭਵ ਨਹੀਂ ਮੈਂ ਲੋਕਾਂ ਲਈ ਲੋਕਾਂ ਦੀ ਗੱਲ ਲਿਖਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਜਦੋਂ ਵੀ ਮੈਨੂੰ ਬਹੁਤ ਸਾਰੇ ਜਦੋਂ ਵੀ ਮੈਂ ਕੋਈ ਲਿਖਦਾ ਤਾਂ ਮੈਨੂੰ ਫੀਡਬੈਕ ਮਿਲਦਾ ਹੈ ਤਾਂ ਮੈਂ ਉਸ ਤੋਂ ਪ੍ਰਭਾਵਿਤ ਵੀ ਹੁੰਦਾ ਹਾਂ ਕਿਉਂਕਿ ਲੋਕਾਂ ਦੇ ਹਿਸਾਬ ਨਾਲ ਲਿਖਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਮੈਨੂੰ ਲੋਕਾਂ ਵੱਲੋਂ ਮਿਲੀ ਹੋਈ ਫੀਡਬੈਕ ਹੀ ਚੰਗਾ ਲਿਖਣ ਵਾਸਤੇ ਪ੍ਰਭਾਵਿਤ ਕਰਦੀ ਹੈ ਜੇ ਅੱਜ ਮੈਂ ਕੁਛ ਚੰਗਾ ਲਿਖ ਸਕਦਾ ਤਾਂ ਲੋਕਾਂ ਦੀ ਮਿਲੀ ਹੋਈ ਫੀਡਬੈਕ ਦੇ ਜ਼ਰੀਏ ਹੀ ਲਿਖ ਸਕਦਾ ਹਾਂ